ਪੰਜਾਬੀ ਭਾਸ਼ਾ ਆਪਣੇ ਆਪ ਵਿੱਚ ਇੱਕ ਪੂਰੀ ਸੰਪੂਰਨ ਭਾਸ਼ਾ ਹੈ ਇਸ ਦਾ ਹਰ ਇੱਕ ਅੱਖਰ ਆਪਣੇ ਆਪ ਦੇ ਵਿੱਚ ਸੰਪੂਰਨ ਹੈ ਇਹਨੂੰ ਚਾਹੇ ਤੁਸੀਂ ਕਿਤੇ ਮਰਜੀ ਬੋਲੋ ਜਾਂ ਕਿਸੇ ਮਰਜੀ ਮੂਹਰੇ ਬੋਲੋ ਉਹ ਤਾਂ ਉਹ ਇਸ ਭਾਸ਼ਾ ਨੂੰ ਦੇਖਣ ਸਾਰ ਹੀ ਪਹਿਚਾਣ ਲੈਂਦਾ ਗਾ ਵੀ ਇਹ ਬੰਦੇ ਪੰਜਾਬੀ ਨੇ ਕਿਉਂਕਿ ਇਹ ਨੈਸ਼ਨਲ ਅਤੇ ਇੰਟਰਨੈਸ਼ਨਲ ਦੋਵਾਂ ਤੌਰ 'ਤੇ ਇਹ ਭਾਸ਼ਾ ਨੂੰ ਇੱਕ ਵੱਖਰੀ ਪਹਿਚਾਣ ਮਿਲੀ ਹੋਈ ਹੈ ਜਿਹਦਾ ਸਭ ਤੋਂ ਵੱਡੀ ਉਦਾਹਰਣ ਹੈ ਇਸਦਾ ਇਤਿਹਾਸ ਪੰਜਾਬੀ ਇੱਕ ਇਹੋ ਜਿਹੀ ਲੈਂਗੂਏਜ ਹੈ ਜਿਹਨੂੰ ਸਿੱਖਣਾ ਵੀ ਬਹੁਤ ਅਸਾਨ ਹੈ ਅਤੇ ਜਿਹਨੂੰ ਲਿਖਣਾ ਤਾਂ ਉਸ ਤੋਂ ਵੀ ਅਸਾਨ ਹੈ ਇਸਦੇ ਜੋ ਅੱਖਰ ਨੇ ਉਹ ਗੁਰਮੁਖੀ ਲਿਪੀ ਵਿੱਚ ਲਿਖੇ ਗਏ ਆ ਜੋ ਜੋ ਜਿਨ੍ਹਾਂ ਨਾਲ ਪੰਜਾਬੀ ਲਿਖੀ ਜਾਂਦੀ ਹੈ ਉਨ੍ਹਾਂ ਨੂੰ ਗੁਰਮੁਖੀ ਲਿਪੀ ਕਿਹਾ ਜਾਂਦਾ ਗਾ ਜੋ ਕੇ ਸਿੱਖਾਂ ਦੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਨੇ ਲਿਖੀ ਸੀ